ਸਾਡੇ ਇਲਾਕੇ ਵਿੱਚ ਜੋ ਸੜਕਾਂ ਹਨ ਉਹ ਆਮ ਤੌਰ ਉੱਤੇ ਸਿੰਗਲ ਸੜਕਾਂ ਹਨ ਆਮ ਤੌਰ ਉੱਤੇ ਜਦੋਂ ਦੋ ਚਾਰ ਪਹੀਆ ਵਾਹਨ ਇੱਕ ਦੂਸਰੇ ਨੂੰ ਕਰੋਸ ਕਰਦੇ ਹਨ ਤਾਂ ਦੋਹਾਂ ਵਿੱਚੋਂ ਇੱਕ ਨੂੰ ਹਰ ਹਾਲ ਦੇ ਵਿੱਚ ਵਾਹਨ ਕੱਚੇ ਵਿੱਚ ਉਤਾਰਨਾ ਪੈਂਦਾ ਹੈ ਤਾਂ ਹੀ ਦੋ ਚਾਰ ਪਹੀਆ ਵਾਹਨ ਇੱਕ ਦੂਜੇ ਨੂੰ ਕਰੋਸ ਕਰ ਪਾਉਂਦੇ ਹਨ ਜਿਸ ਕਾਰਨ ਸਾਡੇ ਸਾਰੇ ਹੀ ਰੋਡ ਡਬਲ ਹੋਣੇ ਚਾਹੀਦੇ ਹਨ ਦੂਸਰਾ ਜਿਹੜੀਆਂ ਲਿੰਕ ਸੜਕਾਂ ਹਨ ਇੱਕ ਦੂਜੇ ਨੂੰ ਜੋੜਦੀਆਂ ਜਾਂ ਜਿਹੜੇ ਖਤਰਨਾਕ ਮੋੜ ਹਨ ਉਹਨਾਂ ਉੱਤੇ ਰਾਤ ਵੇਲੇ ਵਧੇਰੇ ਦੁਰਘਟਨਾਵਾਂ ਹੁੰਦੀਆਂ ਹਨ ਜਿਸ ਕਾਰਨ ਉੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੇ ਇਲਾਕਿਆਂ ਦੇ ਵਿੱਚ ਬੱਸਾਂ ਲੱਗੀਆਂ ਹੋਈਆਂ ਹਨ ਰੂਟ ਬਣਾ ਕੇ ਉੱਥੇ ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਉਹ ਗੁਜ਼ਰਦੀਆਂ ਹਨ ਉਹਨਾਂ ਦੇ ਰੂਟ ਅਤੇ ਸਮੇਂ ਲਿਖੇ ਹੋਣੇ ਚਾਹੀਦੇ ਹਨ ਤਾਂ ਜੋ ਯਾਤਰੀਆਂ ਨੂੰ ਪਤਾ ਲੱਗ ਸਕੇ ਕਿ ਕਦੋਂ ਕਿੰਨੇ ਵਜੇ ਕਿਹੜੇ ਸਥਾਨ ਉੱਤੇ ਬੱਸ ਆਵੇਗੀ ਇਹਨਾਂ ਨਾਲ ਆਵਾਜਾਈ ਅਤੇ ਯਾਤਰਾ ਦੇ ਸਾਧਨ ਚੰਗੇ ਬਣ ਸਕਦੇ ਹਨ ਧੰਨਵਾਦ